ਮੈਂ ਦੌੜਦੇ ਸਮੇਂ ਕਾਫੀ ਸੱਟਾਂ ਦਾ ਅਨੁਭਵ ਕੀਤਾ ਕਈ ਵਾਰ ਤਾਂ ਸੱਟਾਂ ਨੌਰਮਲ ਲੱਗ ਜਾਂਦੀਆਂ ਕਈ ਵਾਰ ਸੱਟ ਜ਼ਿਆਦਾ ਵੀ ਲੱਗ ਜਾਂਦੀ ਹੈ ਅਤੇ ਉਸ ਉਹਦਾ ਮੈਂ ਜਾ ਕੇ ਫਿਰ ਕਈ ਵਾਰੀ ਡਾਕਟਰੀ ਇਲਾਜ ਵੀ ਕਰਵਾਉਂਦਾ ਹਾਂ ਜੇਕਰ ਸੱਟ ਛੋਟੀ ਮੋਟੀ ਹੁੰਦੀ ਹੈ ਤਾਂ ਫਿਰ ਮੈਂ ਘਰ ਦੇ ਟਰੀਟਮੈਂਟ ਦੇ ਨਾਲ ਹੀ ਉਹਨੂੰ ਅ ਮਲ ਕੇ ਐਡਜਸਟ ਕਰ ਲੈਂਦਾ ਹਾਂ ਅਤੇ ਜੇ ਮੇਰੇ ਕਿਤੇ ਸੱਟ ਜ਼ਿਆਦਾ ਲੱਗ ਜਾਂਦੀ ਹੈ ਤਾਂ ਫਿਰ ਮੈਨੂੰ ਕਈ ਵਾਰੀ ਹੋਸਪਿਟਲ ਵੀ ਜਾਣਾ ਪੈਂਦਾ ਡੌਕਟਰ ਨੂੰ ਹੱਡੀਆਂ ਵਾਲੇ ਡਾਕਟਰ ਨੂੰ ਦਿਖਾ ਕੇ ਅਤੇ ਫਿਰ ਉਹਨੂੰ ਮੈਂ ਸਹੀ ਕਰਵਾਉਂਦਾ ਹਾਂ ਕਈ ਵਾਰ ਮੇਰੇ ਪਲਸਤਰ ਵੀ ਲੱਗਿਆ ਇਸ ਕਰਕੇ ਮੈਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਮੈਂ ਕਦੀ ਆਪਣਾ ਮਨ ਜਿਹੜਾ ਉਹ ਨਹੀਂ ਡੋਲਾਇਆ ਕਿਉਂਕਿ ਆਪਣੇ ਸਰੀਰ ਨੂੰ ਸੈਟ ਕਰਨ ਵਾਸਤੇ ਦੌੜਨਾ ਜ਼ਰੂਰੀ ਹੈ ਅਸੀਂ ਦੌੜਦੇ ਹਾਂ ਅਤੇ ਸਾਡਾ ਜਿਹੜਾ ਸਰੀਰ ਆ ਉਹ ਸਹੀ ਰਹਿੰਦਾ ਹੈ ਅਤੇ ਸੱਟਾਂ ਤਾਂ ਲੱਗ ਹੀ ਜਾਂਦੀਆਂ ਕਈ ਵਾਰੀ ਪੈਰ ਨੂੰ ਮਸਕੋੜ ਜਿਹੀ ਆ ਜਾਂਦੀ ਹੈ ਅਤੇ ਕਈ ਵਾਰ ਡਿੱਗ ਵੀ ਪਈਦਾ ਜਦੋਂ ਕਿਤੇ ਖੱਡਾ ਆ ਜਾਂਦਾ ਅਤੇ ਕਈ ਵਾਰੀ ਗੋਡਿਆਂ 'ਤੇ ਵੀ ਸੱਟਾਂ ਲੱਗ ਜਾਂਦੀਆਂ ਪਰ ਜਿਹੜੀਆਂ ਛੋਟੀਆਂ ਮੋਟੀਆਂ ਰਗੜਾਂ ਉਹ ਅਸੀਂ ਜ਼ਿਆਦਾ ਮਹਿਸੂਸ ਨਹੀਂ ਕਰਦੇ ਜਦੋਂ ਕੋਈ ਜ਼ਿਆਦਾ ਸੱਟ ਲੱਗਦੀ ਫਿਰ ਅਸੀਂ ਹੋਸਪਿਟਲ ਜਾਂਦੇ ਹਾਂ